ਪੰਜਾਬ ਵਿੱਚ ਈਕੋ ਟੂਰਿਜ਼ਮ ਦੇ ਬਹੁਤ ਮੌਕੇ ਹਨ ਕਿਉਂਕਿ ਪੰਜਾਬ ਵਿੱਚ ਹਰਿਮੰਦਰ ਸਾਹਿਬ ਹੋਣ ਕਰਕੇ ਸਾਰੇ ਸੰਸਾਰ ਭਰ ਵਿੱਚੋਂ ਸੈਲਾਨੀ ਲੱਖਾਂ ਦੀ ਗਿਣਤੀ ਵਿੱਚ ਆਉਂਦੇ ਹਨ ਉਹਨਾਂ ਨੂੰ ਇੱਕ ਵਧੀਆ ਤੇ ਸੁਰੱਖਿਅਤ ਮਾਹੌਲ ਦੇਣ ਲਈ ਈਕੋ ਟੂਰਿਜ਼ਮ ਬਹੁਤ ਸਹਾਇਤਾ ਕਰਦੀ ਹੈ ਜਨਵਰਿਆਂ ਤੋਂ ਜਾਨਵਰਾਂ ਤੋਂ ਸੁਰੱਖਿਆ ਲਈ ਅਲੱਗ ਅਲੱਗ ਟੀਮਾਂ ਬਣਾਈ ਹੋਈ ਹੈ ਜੋ ਅਵਾਰਾ ਜਾਨਵਰਾਂ ਨੂੰ ਚੁੱਕ ਕੇ ਲੈ ਜਾਂਦੇ ਹਨ ਤਾਂ ਕਿ ਉਹ ਸੈਲਾਨੀਆਂ ਨੂੰ ਪਰੇਸ਼ਾਨ ਨਾ ਨਾ ਕਰਨ ਫਿਰ ਸੁੰਦਰ ਪਾਰਕ ਬਣਾ ਕੇ ਸੁੰਦਰ ਪੇੜ ਪੌਦੇ ਲਗਾ ਕੇ ਸੁੰਦਰ ਮਾਹੌਲ ਬਣਾ ਕੇ ਪੇਸ਼ ਕਰ ਸਕਦੇ ਹਾਂ ਤਾਜੀ ਹਵਾ ਖੁਸ਼ਬੂਦਾਰ ਮਾਹੌਲ ਦੇ ਸਕਦੇ ਹਾਂ ਜਗ੍ਹਾ ਜਗ੍ਹਾ 'ਤੇ ਬੰਦਿਆਂ ਦੀ ਡਿਊਟੀ ਲਗਾ ਕੇ ਤੈਨਾਤ ਕਰ ਸਕਦੇ ਹਾਂ ਤਾਂ ਕਿ ਉਹ ਕੋਈ ਮਨੋਰੰਜਨ ਦੀਆਂ ਵਸਤੂਆਂ ਨੂੰ ਖ਼ਰਾਬ ਨਾ ਕਰੇ ਥਾਂ ਥਾਂ 'ਤੇ ਡਸਟਬਿਨ ਲਗਾ ਕੇ ਰੱਖਣ ਤਾਂ ਕਿ ਕੋਈ ਖਾਣਾ ਖਾ ਕੇ ਵੇਸਟ ਚੀਜ਼ਾਂ ਨੂੰ ਇੱਧਰ ਉੱਧਰ ਨਾ ਖਿਲਾਰਨ